ਭਾਰਤੀ ਸਿੱਖਿਆ ਪ੍ਰਣਾਲੀ ਨੂੰ ਜੇਕਰ ਉਦੇਸ਼ ਦੇ ਨਾਲ਼ ਤੁਲਨਾ ਕਰਕੇ ਦੇਖਿਆ ਜਾਵੇ ਤਾਂ ਇਹ ਸਾਹਮਣੇ ਆਉਂਦਾ ਹੈ ਕਿ ਸਾਡਾ ਪੜ੍ਹਾਈ ਦਾ ਜੋ ਮਟੀਰੀਅਲ ਹੈ ਉਹ ਉਹਨਾਂ ਤੋਂ ਅਜੇ ਕਾਫ਼ੀ ਪਿੱਛੇ ਹੈ ਕਿਉਂਕਿ ਜਿਹੜੀਆਂ ਵੀ ਨਵੀਆਂ ਖੋਜਾਂ ਜਾਂ ਸੋਧਾਂ ਹੋਈਆਂ ਹਨ ਉਹ ਅਜੇ ਸਾਡੇ ਭਾਰਤੀ ਸਿੱਖਿਆ ਦੀਆਂ ਕਿਤਾਬਾਂ ਵਿੱਚ ਸ਼ਾਮਿਲ ਨਹੀਂ ਕੀਤੀਆਂ ਗਈਆਂ ਅਤੇ ਸਭ ਤੋਂ ਵੱਡੀ ਘਾਟ ਮੈਨੂੰ ਇਹੀ ਲੱਗਦੀ ਹੈ ਕਿ ਬੱਚਿਆਂ ਨੂੰ ਸਮੇਂ ਸਿਰ ਜੋ ਵੀ ਖੋਜਾਂ ਜਾਂ ਕਾਢਾਂ ਹੋਈਆਂ ਹਨ ਉਹਦੇ ਨਾਲ਼ ਅਪਡੇਟ ਕਰਦੇ ਰਹਿਣਾ ਚਾਹੀਦਾ ਹੈ ਅਤੇ ਇੱਕ ਦਿੱਕਤ ਜੋ ਭਾਰਤੀ ਸਿੱਖਿਆ ਪ੍ਰਣਾਲੀ ਵਿੱਚ ਹੈ ਉਹ ਇਹ ਹੈ ਕਿ ਇੱਥੇ ਥਿਊਰੀ ਦਾ ਕੰਮ ਜਾਂ ਲਿਖਤੀ ਕੰਮ ਜ਼ਿਆਦਾ ਕਰਵਾਇਆ ਜਾਂਦਾ ਹੈ ਜਦਕਿ ਬੱਚੇ ਨੂੰ ਕਲਾਤਮਕ ਤੌਰ 'ਤੇ ਉੱਚਾ ਚੁੱਕਣ ਲਈ ਉਨ੍ਹਾਂ ਨੂੰ ਪ੍ਰੈਕਟੀਕਲ ਵੱਲ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਹੈ ਜਿਵੇਂ ਕਿ ਵਿਦੇਸ਼ਾਂ ਵਿੱਚ ਆਪਾਂ ਦੇਖ ਹੀ ਸਕਦੇ ਹਾਂ ਕਿ ਉੱਥੇ ਪ੍ਰੈਕਟੀਕਲ ਕੰਮ ਵੱਲ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ ਅਤੇ ਜੇਕਰ ਭਾਰਤ ਵਿੱਚ ਸਿੱਖਿਆ ਪ੍ਰਣਾਲੀ ਨੂੰ ਪ੍ਰੈਕਟੀਕਲ ਉੱਤੇ ਆਧਾਰਿਤ ਕਰ ਦੇਈਏ ਤਾਂ ਭਾਰਤ ਦੇ ਬੱਚੇ ਦੂਜੇ ਬੱਚਿਆਂ ਨਾਲ਼ ਜੋ ਬਾਹਰਲੇ ਦੇਸ਼ਾਂ ਦੇ ਹਨ ਉਹਨਾਂ ਨਾਲ਼ ਟੱਕਰ ਲੈ ਸਕਦੇ ਹਨ ਅਤੇ ਇਸ ਤੋਂ ਇਲਾਵਾ ਚੁਣੌਤੀਆਂ ਇਹ ਹਨ ਕਿ ਕੁਝ ਅਧਿਆਪਕ ਜੋ ਬਹੁਤ ਤਨਦੇਹੀ ਨਾਲ਼ ਪੜ੍ਹਾਉਂਦੇ ਹਨ ਅਤੇ ਕੁਝ ਅਜਿਹੇ ਅਧਿਆਪਕ ਵੀ ਹਨ ਜਿਹੜੇ ਕਿ ਬੱਚਿਆਂ ਦਾ ਸਮਾਂ ਖ਼ਰਾਬ ਹੀ ਕਰਦੇ ਹਨ ਉਹ ਲੈਕਚਰਾਂ ਦੇ ਵਿੱਚ ਐਵੇਂ ਬੈਠੇ ਰਹਿੰਦੇ ਹਨ ਬੱਚਿਆਂ ਨੂੰ ਉਸ ਹਿਸਾਬ ਨਾਲ਼ ਨਹੀਂ ਸਮਝਾਉਂਦੇ ਅਤੇ ਆਪਣਾ ਸਮਾਂ ਪੂਰਾ ਕਰਕੇ ਲੈਕਚਰ 'ਚੋਂ ਚਲੇ ਜਾਂਦੇ ਹਨ ਅਤੇ ਸਿੱਖਿਆ ਨਾਲ਼ ਸੰਬੰਧਿਤ ਜਿਹੜੇ ਵੀ ਅਫ਼ਸਰ ਹਨ ਉਹਨਾਂ ਨੂੰ ਚਾਹੀਦਾ ਹੈ ਕਿ ਅਜਿਹੇ ਸਕੂਲਾਂ ਵਿੱਚ ਜਾਂ ਕਾਲਜਾਂ ਵਿੱਚ ਵਾਰ ਵਾਰ ਰੇਡ ਮਾਰੀ ਜਾਵੇ ਅਤੇ ਦੇਖਿਆ ਜਾਵੇ ਕਿ ਉਹਨਾਂ ਦੀ ਕਿਹੋ ਜਿਹੀ ਸਥਿਤੀ ਹੈ ਅਤੇ ਉਹ ਪੜ੍ਹਾਉਣ ਵਿੱਚ ਕਿਹੋ ਜਿਹੀ ਰੁਚੀ ਲੈਂਦੇ ਹਨ ਜਿਵੇਂ ਕਿ ਬੱਚਿਆਂ ਦੇ ਪੇਪਰ ਹੁੰਦੇ ਹਨ ਇਵੇਂ ਹੀ ਅਧਿਆਪਕਾਂ ਦੇ ਵੀ ਟੈਸਟ ਲਏ ਜਾਣ ਤਾਂ ਜੋ ਪਤਾ ਚੱਲ ਸਕੇ ਕਿ ਉਹ ਸਮੇਂ ਦੇ ਨਾਲ਼ ਨਾਲ਼ ਆਪਣੇ ਆਪ ਨੂੰ ਬਦਲ ਰਹੇ ਹਨ ਅਤੇ ਅਪਡੇਟ ਕਰ ਰਹੇ ਹਨ ਜਾਂ ਨਹੀਂ ਜੇਕਰ ਅਧਿਆਪਕ ਅਜਿਹਾ ਨਹੀਂ ਕਰ ਰਹੇ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਅਧਿਆਪਕਾਂ ਨੂੰ ਕੁਝ ਸਮੇਂ ਲਈ ਬਰਖ਼ਾਸਤ ਕਰ ਦਿੱਤਾ ਜਾਵੇ ਤਾਂ ਜੋ ਉਹ ਸਮੇਂ ਦੇ ਨਾਲ਼ ਅਪਡੇਟ ਹੋ ਸਕਣ